ਸਾਡੇ ਖੇਤਰ ਵਿੱਚ ਅ ਕੁਦਰਤੀ ਸਰੋਤ ਜਿਵੇਂ ਕਿ ਖੁੱਲ੍ਹੇ ਮੈਦਾਨ ਹਨ ਜਿੱਥੇ ਫੈਕਟਰੀਆਂ ਲਗਾਈਆਂ ਜਾ ਸਕਦੀਆਂ ਹਨ ਦੂਜਾ ਇਹ ਹੈ ਕਿ ਸਾਡੇ ਖੇਤਰ ਵਿੱਚ ਉਪਜਾਊ ਜਮੀਨ ਹੈ ਜਿਸ ਦੇ ਵਿੱਚ ਅਸੀਂ ਗੰਨੇ ਉਗਾ ਸਕਦੇ ਹਾਂ ਜਿਸ ਦੇ ਵਿੱਚ ਅਸੀਂ ਫ਼ਲ ਫਰੂਟ ਉਗਾ ਸਕਦੇ ਹਾਂ ਜਿਸ ਦੇ ਵਿੱਚ ਅਸੀਂ ਅਲੱਗ ਅਲੱਗ ਜੜ੍ਹੀ ਬੂਟੀਆਂ ਉਗਾ ਸਕਦੇ ਹਾਂ ਜਿਹੜੀਆਂ ਅਲੱਗ ਸਾਡੇ ਮੈਡੀਕਲ ਪਰਪਸ ਲਈ ਸਾਡੇ ਦਵਾਈਆਂ ਬਣਾਉਣ ਦੇ ਲਈ ਵਰਤੀਆਂ ਜਾਂਦੀਆਂ ਹਨ ਅਤੇ ਹੋਰ ਜਿਹੜੀ ਚੀਜ਼ਾਂ ਆਉਂਦੀਆਂ ਜਿੱਦਾਂ ਕਿ ਕੋਟਨ ਹੈ ਕੋਟਨ ਵੀ ਉਗਾਈ ਜਾਂਦੀ ਆ ਪੰਜਾਬ ਸਾਡੇ ਖੇਤਰ ਦੇ ਵਿੱਚ ਜਿਹੜੇ ਕਿ ਅਸੀਂ ਖੁੱਲ੍ਹੇ ਮੈਦਾਨ ਵਿੱਚ ਇੱਕ ਫੈਕਟਰੀ ਬਣਾ ਕੇ ਉੱਥੇ ਲਗਾਈ ਜਾ ਸਕਦੀ ਹੈ ਅਤੇ ਉਹ ਰੂੰ ਤੋਂ ਅੱਗੇ ਕੱਪੜਾ ਬਣਾਇਆ ਜਾ ਸਕਦਾ ਹੈ ਜਿਹੜਾ ਕਿ ਮਾਰਕੀਟ ਦੇ ਵਿੱਚ ਵਧੀਆ ਢੰਗ ਨਾਲ ਵਧੀਆ ਰੇਟ 'ਤੇ ਸੇ ਵੇਚਿਆ ਜਾ ਸਕਦਾ ਹੈ ਤਾਂ ਇੱਦਾਂ ਦੇ ਕੁਛ ਚੀਜ਼ਾਂ ਨੇ ਜਿਹੜੀਆਂ ਸਾਡੇ ਖੇਤਰ ਦੇ ਵਿੱਚ ਫੈਕਟਰੀਆਂ ਨੂੰ ਅੱਗੇ ਵਧਾ ਸਕਦੀਆਂ ਹਨ ਅਤੇ ਵਧੀਆ ਲੈਵਲ 'ਤੇ ਲੈ ਕੇ ਜਾ ਸਕਦੀਆਂ ਹਨ